ਭਾਰਤ ਵਿੱਚ ਬਹੁਤ ਸਾਰੇ ਨੇਤਾ ਹਨ ਜਿਹਨਾਂ ਨੇ ਭਾਰਤ ਨੂੰ ਬੜੇ ਤਰੀਕਿਆਂ ਨਾਲ ਬਦਲਿਆ ਹੈ ਉਨਾਂ ਵਿੱਚੋਂ ਮੈਂ ਭਗਵੰਤ ਮਾਨ ਨੂੰ ਪਿਛਲੇ ਕੁਝ ਸਾਲਾਂ ਤੋਂ ਜਾਣਦੀ ਹਾਂ ਭਗਵੰਤ ਮਾਨ ਨੇ ਪੰਜਾਬ ਕਿਹਾ ਕਿ ਪੰਜਾਬ ਸਰਕਾਰ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਗੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਅਜਿਹੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ ਕਿ ਇੱਥੇ ਅੰਗਰੇਜ਼ ਵੀ ਨੌਕਰੀ ਕਰਨ ਆਉਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਤਕਨੀਕੀ ਸਿੱਖਿਆ ਦਾ ਯੁੱਗ ਹੈ ਉਹਨਾਂ ਨੇ ਪੰਜਾਬ ਵਿੱਚ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਲੋਕਾਂ ਤੋਂ ਕੁਝ ਸਮਾਂ ਮੰਗਦਿਆਂ ਨੌਜਵਾਨਾਂ ਨੂੰ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਖਾਸ ਕਰਕੇ ਲੜਕੀਆਂ ਨੂੰ ਆਪਣੀ ਪਸੰਦ ਦੇ ਖੇਤਰਾਂ ਵਿੱਚ ਮੱਲਾਂ ਮਾਰਨ ਦੀ ਆਜ਼ਾਦੀ ਦੇਣ ਉਹਨਾਂ ਨੇ ਕਿਹਾ ਕਿ ਤਿੰਨ ਸੌ ਯੂਨਿਟ ਤੱਕ ਬਿਜਲੀ ਦਾ ਬਿੱਲ ਜ਼ੀਰੋ ਆਵੇਗਾ ਅਤੇ ਉਹ ਵੀ ਉਹਨਾਂ ਨੇ ਪੂਰਾ ਕੀਤਾ ਹੈ ਅਤੇ ਉਹ ਅਸੀਂ ਬੱਚਤ ਕਰਦੇ ਹਾਂ ਅਤੇ ਉਨ ਉਨ ਉਸ ਦਾ ਸਾਨੂੰ ਇਹ ਫਾਇਦਾ ਹੋਇਆ ਹੈ ਕਿ ਉਹਨਾਂ ਪੈਸਿਆਂ ਦੇ ਨਾਲ ਅਸੀਂ ਆਪਣੇ ਬੱਚੇ ਉਹਨਾਂ ਬਚਾ ਕੇ ਅਸੀਂ ਆਪਣੇ ਬੱਚੇ ਦੀ ਕਾਲਜ ਦੀ ਫੀਸ ਇਹ ਭੇਜਦੇ ਹਾਂ ਅਤੇ ਜਿਹਦੇ ਨਾਲ ਉਹਦਾ ਪੜ੍ਹਨ ਦਾ ਵੀ ਸੁਪਨਾ ਪੂਰਾ ਹੋ ਗਿਆ ਹੈ ਅਤੇ ਘਰ ਦਾ ਮਾਹੌਲ ਵੀ ਬਹੁਤ ਵਧੀਆ ਬਣ ਗਿਆ ਹੈ ਅਤੇ ਅਸੀਂ ਉਹਨਾਂ ਦਾ ਜਿੰਨਾਂ ਵੀ ਸ਼ੁਕਰੀਆ ਕਰੀਏ ਉਨਾਂ ਹੀ ਥੋੜ੍ਹਾ ਹੈ ਕਿਉਂਕਿ ਉਹਨਾਂ ਦੇ ਕਰਕੇ ਸਾਡੇ ਘਰ ਦਾ ਮਾਹੌਲ ਬਹੁਤ ਹੀ ਸ਼ਾਂਤੀ ਭਰਿਆ ਬਣ ਗਿਆ ਹੈ ਅਤੇ ਜਿੰਨਾਂ ਵੀ ਅਸੀਂ ਉਹਨਾਂ ਨੂੰ ਦਿਲੋਂ ਅਸੀਸਾਂ ਦੇ ਸਕੀਏ ਉੱਨਾਂ ਅਸੀਂ ਦੇ ਰਹੇ ਹਾਂ ਥੈਂਕਸ